ਜੀ ਹਾਂ ਬਿਲਕੁਲ ਪੰਜਾਬ ਵਿੱਚ ਅ ਅਜਿਹੇ ਕਈ ਸਾਰੇ ਖਰੀਦਾਰੀ ਜ਼ਿਲ੍ਹੇ ਹਨ ਜਿੱਥੇ ਸੈਲਾਨੀਆਂ ਨੂੰ ਬਹੁਤ ਕੁਛ ਮਿਲ ਸਕਦਾ ਹੈ ਜੇਕਰ ਉਹਨਾਂ ਨੇ ਚੰਗੇ ਕੱਪੜੇ ਲੈਣੇ ਨੇ ਰਵਾਇਤੀ ਕੱਪੜੇ ਲੈਣੇ ਨੇ ਪੰਜਾਬੀ ਕੱਪੜੇ ਲੈਣੇ ਨੇ ਗਰਮ ਕੱਪੜੇ ਲੈਣੇ ਨੇ ਤਾਂ ਉਹ ਬਿਲਕੁਲ ਅਜਿਹੇ ਪੰਜਾਬ 'ਚ ਬਹੁਤ ਜ਼ਿਲ੍ਹੇ ਨੇ ਜਿੱਥੇ ਉਹ ਜਾ ਸਕਦੇ ਨੇ ਅਤੇ ਬੜੇ ਹੀ ਚੰਗੇ ਰੇਟ 'ਤੇ ਖਰੀਦ ਸਕਦੇ ਨੇ ਜਿਵੇਂ ਕਿ ਪਟਿਆਲਾ ਲੁਧਿਆਣਾ ਅਬੋਹਰ ਇਹ ਜਗ੍ਹਾਵਾਂ ਬਹੁਤ ਮਸ਼ਹੂਰ ਨੇ ਕੱਪੜਿਆਂ ਵਾਸਤੇ ਇੱਥੇ ਲੁਧਿਆਣਾ ਬਹੁਤ ਵੱਡੀ ਕੱਪੜਿਆਂ ਦੀ ਮਾਰਕੀਟ ਹੈ ਜੇਕਰ ਜੇਕਰ ਜੇਕਰ ਕੱਪੜੇ ਖਰੀਦਣੇ ਹੈ ਤਾਂ ਤੁਸੀਂ ਲੁਧਿਆਣਾ ਜਾ ਸਕਦੇ ਹੋ ਬਹੁਤ ਅੱਛੀ ਮਾਰਕੀਟ ਲੱਗਦੀ ਉੱਥੇ ਜਿੱਦਾਂ ਹੋਲਸੇਲ ਦੇ ਵੀ ਕੱਪੜੇ ਖਰੀਦਣੇ ਹੁੰਦੇ ਜਿਹੜੇ ਈਵਨ ਜਿਹੜੇ ਪੰਜਾਬ ਤੋਂ ਬਾਹਰ ਦਿੱਲੀ ਲੋਕ ਦਿੱਲੀ ਵੀ ਇੱਥੋਂ ਕੱਪੜੇ ਲੈ ਕੇ ਜਾਂਦੇ ਨੇ ਹੋਲਸੇਲ 'ਤੇ ਖਰੀਦ ਕੇ ਬੜੇ ਅੱਛੇ ਰੇਟਸ 'ਤੇ ਕੱਪੜੇ ਮਿਲ ਜਾਂਦੇ ਆ ਲੁਧਿਆਣੇ ਹਰ ਤਰ੍ਹਾਂ ਦੇ ਕੱਪੜੇ ਅਤੇ ਉੱਥੇ ਬਜ਼ਾਰ ਲੱਗਦੇ ਲੁਧਿਆਣਾ ਤੁਸੀਂ ਜ਼ਰੂਰ ਜਾਉ ਲੁਧਿਆਣਾ ਬਹੁਤ ਫੈਕਟਰੀਜ਼ ਨੇ ਜਿਹੜੀ ਕਿ ਬਹੁਤ ਮਸ਼ਹੂਰ ਨੇ ਸਭ ਨੂੰ ਪਤਾ ਕਿ ਲੁਧਿਆਣਾ ਇਹੋ ਜਿਹੀਆਂ ਕਈ ਫੈਕਟਰੀਜ਼ ਨੇ ਜਿੱਥੋਂ ਕਿ ਤੁਸੀਂ ਕੱਪੜੇ ਖਰੀਦ ਸਕਦੇ ਹੋ ਬਲਕ 'ਚ ਵੀ ਲੈ ਸਕਦੇ ਹੋ ਅਤੇ ਜਿਹੜੇ ਸੈਲਾਨੀ ਨੇ ਉਹਨਾਂ ਨੂੰ ਪਟਿਆਲਾ ਵੀ ਜਾਣਾ ਚਾਹੀਦਾ ਦੇਖਣ ਲਈ ਅਤੇ ਲੁਧਿਆਣੇ ਵੀ